ਹੈਲੋ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਾਡੀ ਦੁਕਾਨ 'ਤੇ ਸਾਰੇ ਹੀ ਪ੍ਰਕਾਰ ਦੇ ਮਿਲਦੇ ਹੈ ਜੀ ਵਧੀਆ ਤੋਂ ਵਧੀਆ ਅਤੇ ਕੋਈ ਮਹਿੰਗੇ ਵੀ ਹੈਗੇ ਗੁਲਦਸਤੇ ਕੋਈ ਸਸਤੇ ਵੀ ਹੈ ਤੁਸੀਂ ਕਿਹੜੇ ਲੈਣਾ ਪਸੰਦ ਕਰਦੇ ਹੋ ਅੱਛਾ ਜੀ ਹਾਂਜੀ ਅੱਛਾ ਜੀ ਹੋਰ ਸਾਡੀ ਦੁਕਾਨ ਦੀ ਕੁਆਲਿਟੀ ਬਹੁਤ ਵਧੀਆ ਜੀ ਤੁਸੀਂ ਇੱਕ ਵਾਰੀ ਜੇ ਲੈ ਗਏ ਤਾਂ ਫਿਰ ਦੁਬਾਰਾ ਆਪਣੇ ਫਰੈਂਡਸ ਨੂੰ ਵੀ ਦੱਸੋਗੇ ਵੀ ਉਹਨਾਂ ਦੀ ਦੁਕਾਨ ਤੋਂ ਬਹੁਤ ਵਧੀਆ ਫਲਾਵਰ ਮਿਲਦੇ ਆ ਅੱਛਾ ਹਾਂਜੀ ਜਿਹੜੇ ਗੁਲਾਬ ਵਾਲੇ ਫਲਾਵਰਾਂ ਦੀ ਗੁਲਦਸਤੇ ਹੈ ਜੀ ਉਹਨਾਂ ਦਾ ਪ੍ਰਾਈਜ ਤਾਂ ਢਾਈ ਸੌ ਰੁਪਏ ਹੈ ਅਤੇ ਜਿਹੜੇ ਦੂਸਰੇ ਸੂਰਜਮੁਖੀ ਵਾਲੇ ਹੈ ਜੀ ਉਹਨਾਂ ਦਾ ਤਿੰਨ ਸੌ ਰੁਪਏ ਪ੍ਰਾਈਜ ਹੈ ਅਤੇ ਇੱਕ ਥੋੜ੍ਹੇ ਜਿਹੇ ਜੋ ਵਧੀਆ 'ਚ ਹੈਗੇ ਉਹ ਮਹਿੰਗੇ ਆ ਉਹਨਾਂ ਦਾ ਪ੍ਰਾਈਜ ਥੋੜ੍ਹਾ ਜਿਹਾ ਮਹਿੰਗਾ ਜੀ ਪੰਜ ਸੌ ਰੁਪਏ ਹੈ ਜੀ ਉਹ ਤਾਂ ਹਾਂਜੀ ਤੁਸੀਂ ਦੇਖ ਲਓ ਜੀ ਜਿਹੜੇ ਤੁਹਾਨੂੰ ਵਧੀਆ ਲੱਗਦੇ ਉਹੀ ਲੈ ਲਿਓ ਅੱਛਾ ਜੀ ਅੱਛਾ ਹੋਰ ਜੀ ਅੱਛਾ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂ ਮਨੀ ਪਲਾਟ ਜੇ ਤੁਸੀਂ ਆਪਣੇ ਘਰ ਲਾਉਗੇ ਤਾਂ ਉਹ ਵਧੀਆ ਹੁੰਦਾ ਬਹੁਤ ਸੋਹਣਾ ਲੱਗਦਾ ਹਾਂਜੀ ਠੀਕ ਹੈ ਅੱਛਾ ਜੀ ਹਾਂਜੀ

ਹਾਂਜੀ ਠੀਕ ਹੈ ਜੀ ਹਾਂ ਸਾਡੇ ਜਿਹੜੇ ਗੁਲਾ ਉਹਨਾਂ ਦੇ ਪਲਾਂਟਾਂ ਦੇ ਕਲਰ ਹੈ ਜੀ ਉਹ ਖ਼ਰਾਬ ਨਹੀਂ ਹੋਣਗੇ ਬਿਲਕੁਲ ਬਹੁਤ ਸੋਹਣੇ ਅਸੀਂ ਵਧੀਆ ਸਪੈਸ਼ਲ ਲੈ ਕੇ ਆਉਂਦੇ ਹਾਂ ਮਾਲ ਤੇ ਠੀਕ ਹੈ ਥੈਂਕ ਯੂ